ਵੀਰੇ ਐਮਾਜ਼ੋ ਕਸਟਮਰ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਬੁੱਕ ਆਰਡਰ ਕੀਤੀ ਸੀ ਚਿੜੀਆਂ ਦਾ ਚੰਬਾ ਮੈਂ ਬੁੱਕ ਤਿੰਨ ਚਾਰ ਦਿਨ ਹੋ ਗਏ ਆਰਡਰ ਕੀਤੀ ਨੂੰ ਉਹ ਹਜੇ ਤੱਕ ਆਈ ਨਹੀਂ ਅਤੇ ਜਿਸ ਬੁੱਕ ਆ ਗਈ ਅਤੇ ਮੈਂ ਬੁੱਕ ਖੋਲ੍ਹੀ ਅਤੇ ਨਾ ਤਾਂ ਪੈਕਿੰਗ ਵਧੀਆ ਸੀ ਅਤੇ ਜਦੋਂ ਵਿੱਚੋਂ ਬੁੱਕ ਓਪਨ ਕੀਤੀ ਤਾਂ ਬੁੱਕ ਦੇ ਪੇਜ ਫਟੇ ਹੋਏ ਸੀ ਅਤੇ ਵਿੱਚੋਂ ਮਤਲਬ ਪ੍ਰਿੰਟਿੰਗ ਵੀ ਸਾਫ਼ ਨਹੀਂ ਸੀ ਅਤੇ ਮੈਂ ਪੜ੍ਹਨਾ ਚਾਹੁੰਦੀ ਸੀ ਮੈਨੂੰ ਬੁੱਕਾਂ ਦਾ ਬਹੁਤ ਸ਼ੌਂਕ ਸੀ ਪਰ ਤੁਸੀਂ ਮੇਰਾ ਆਹ ਵਾਲਾ ਆਰਡਰ ਬਹੁਤ ਬੇਕਾਰ ਭੇਜਿਆ ਇਸ ਕਰਕੇ ਮੇਰਾ ਜੀ ਨਹੀਂ ਕਰਦਾ ਕਿ ਮੈਂ ਹੋਰ ਆਰਡਰ ਭੇਜਾ ਤੁਹਾਨੂੰ ਤੁਸੀਂ ਮੇਰਾ ਫਸਟ ਔਡਰ ਹੀ ਬੇਕਾਰ ਕਰ ਦਿੱਤਾ ਮੈਨੂੰ ਲੱਗਿਆ ਸੀ ਕਿ ਤੁਸੀਂ ਵਧੀਆ ਬੁੱਕ ਭੇਜੋਗੇ ਅਤੇ ਜਦੋਂ ਮੈਂ ਵਿੱਚੋਂ ਖੋਲ੍ਹ ਕੇ ਵੇਖੀ ਅਤੇ ਪੇਜ ਫਟੇ ਸੀ ਅਤੇ ਨਾ ਪ੍ਰਿੰਟਿੰਗ ਸਾਫ਼ ਸੀ ਅਤੇ ਹੁਣ ਮੈਂ ਮੈਂ ਮਨੀ ਜੇ ਤੁਸੀਂ ਮੈਨੂੰ ਅਗਲੀ ਵਾਰ ਵਧੀਆ ਬੁੱਕ ਭੇਜੋਗੇ ਤਾਂ ਮੈਂ ਮਨੀ ਤੁਹਾਨੂੰ ਪੂਰੀ ਤੇ ਪੂਰੀ ਭੇਜੂਗੀ ਜੇ ਤੁਸੀਂ ਐਵੇਂ ਹੀ ਭੇਜੋਗੇ ਤਾਂ ਫਿਰ ਮੈਂ ਮਨੀ ਤੁਹਾਨੂੰ ਹਾਫ ਦੇਊਂਗੀ ਇਸ ਕਰਕੇ ਹੁਣ ਤਾਂ ਮੇਰਾ ਜੀ ਨਹੀਂ ਕਰਦਾ ਕਿ ਮੈਂ ਤੁਹਾਨੂੰ ਔਡਰ ਕਰਾ ਬੁੱਕ ਅਤੇ